ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਸਕੂਲਾਂ ਦੇ ਵਿੱਚ ਕੰਪਲਸਰੀ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਦਫਤਰਾਂ ਦੇ ਵਿੱਚ ਵੀ ਕੰਪਲਸਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ਿਆਦਾਤਰ ਜਿਸ ਤਰ੍ਹਾਂ ਕਿ ਸਾਈਨ ਬੋਰਡ ਹੋਏ ਜਾਂ ਬੱਸਾਂ 'ਤੇ ਬੇਸ ਦੀ ਵਰਤੋਂ ਵੱਧ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਦੁਕਾਨਾਂ ਦੇ ਉੱਪਰ ਵੀ ਸਾਈਨ ਬੋਰਡ ਪੰਜਾਬੀ ਵਿੱਚ ਹੀ ਲੱਗਣੇ ਚਾਹੀਦੇ ਹਨ ਅਤੇ ਇੰਟਰਨੈਟ 'ਤੇ ਵੀ ਇਸ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਕਿ ਇਸ ਦਾ ਪ੍ਰਚਾਰ ਹੋ ਸਕੇ ਅਤੇ ਪੰਜਾਬੀ ਦੇ ਵਿੱਚ ਔਨਲਾਈਨ ਕੋਰਸ ਵੀ ਕੰਪਲਸਰੀ ਹੋਣੇ ਚਾਹੀਦੇ ਹਨ ਤਾਂ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਅੱਗੇ ਵਧਾ ਸਕੀਏ